ਹੈਲੋ ਬਹੁਤ ਵਧੀਆ ਕੀ ਕਰਦਾ ਪਿਆ ਜੀ ਅੱਛਾ ਅੱਛਾ ਲਾ ਰਿਹਾ ਪਨੀਰੀ ਗਰਮੀ ਤਾਂ ਹੈ ਹੀ ਵੀ ਕਿਹੜਾ ਲਾਇਆ ਨਹਿਰ ਦਾ ਪਾਣੀ ਲਾਇਆ ਕਿ ਮੋਟਰ ਹੀ ਛੱਡੀ ਆ ਹਾਂ ਹਾਂ ਅਤੇ ਪਾਣੀ ਕਿਵੇਂ ਤੁਹਾਡੇ ਤਰਾਂ ਹਾਂ ਸਾਡੇ ਪਾਣੀ ਬਹੁਤ ਸਾਡੇ ਤਾਂ ਦੋ ਨੰਬਰ ਦਾ ਪਾਣੀ ਹੈ ਮਿਕਸ ਜਿਹਾ ਮਿਕਸ ਕਰਕੇ ਮਿਕਸ ਕਰਕੇ ਲਾਉਣਾ ਪੈਂਦਾ ਤਾਂ ਜਾ ਕੇ ਫ਼ਸਲ ਹੁੰਦੀ ਆ ਨਹੀਂ ਤਾਂ ਧਰਤੀ ਚਿੱਟੀ ਹੋ ਜਾਂਦੀ ਹੈ ਜਿੱਥੇ ਪਾਣੀ ਦੂਜਾ ਲਾਉਂਦੇ ਹਾਂ ਨਹੀਂ ਵੀਰ ਜੀ ਆਪਾਂ ਥੋੜ੍ਹਾ ਜਿਹਾ ਥਾਂ ਲਾਇਆ ਗਿਆਰਾਂ ਇੱਕੀ ਦਾ ਲਾ ਰਿਹਾ ਇਸ ਵਾਰ ਨਹੀਂ ਨਹੀਂ ਉਹ ਨਹੀਂ ਲਾ ਰਹੇ ਗਿਆ ਆਪਣੇ ਇੰਨਾ ਹੈ ਨਹੀਂ ਇੱਧਰ ਇਟਰੱਸਟ ਇਹਨਾਂ ਲੋਕਾਂ ਦਾ ਦੂਜਾ ਹੀ ਲਾਉਂਦੇ ਗਿਆਰਾਂ ਇੱਕੀ ਜ਼ਿਆਦਾ ਚੱਲਦਾ ਆਪਣੇ ਇੱਧਰ ਹਾਂ ਹਾਂ ਛੇਤੀ ਪੱਕ ਜਾਂਦਾ ਖਰਚਾ ਘੱਟ ਹੁੰਦਾ ਅਤੇ ਪਾਣੀ ਘੱਟ ਲੈਂਦੀ ਆ ਪਾਣੀ ਮਾੜੇ ਹੋਣ ਕਰਕੇ ਆਪਾਂ ਪਾਣੀ ਪਰੋਨੀ ਉਸ ਹਿਸਾਬ ਨਾਲ ਬੀਜਣੀ ਪੈਂਦੀ ਹੈ ਬਾਕੀ ਇਸ ਵਾਰ ਝੋਨਾ ਨਰਮਾ ਨੁਰਮਾ ਵੀ ਬੀਜ ਰਹੇ ਹਾਂ ਥੋੜ੍ਹਾ ਜਿਹਾ ਥਾਂ ਰੇਟ ਰੂਟ ਵਧੀਆ ਦੇ ਰਹੀ ਹੈ ਸਰਕਾਰ ਚੰਗੇ ਹਾਂ ਤੁਸੀਂ ਵੀ ਲਾ ਰਹੇ ਹੋ ਝੋਨਾ ਝਾਨਾ ਕਿ ਨਹੀਂ ਨਾਲ ਕੋਈ ਜੇ ਨਰਮਾ ਅੱਛਾ ਅੱਛਾ ਹਾਂ ਸਾਡੇ ਲਾਉਂਦੇ ਨਾ ਸਬਜ਼ੀਆਂ ਪਾਣੀ ਮਾੜਾ ਨਾ ਪਾਣੀ ਫਿਰ ਮਾੜੇ ਹੋਣ ਕਰਕੇ ਸਬਜ਼ੀ ਹੁੰਦੀ ਨਹੀਂ ਉਨੀ ਹਾਂ ਪਾਣੀ ਨਾਲ ਹੀ ਨਾ ਸਾਰਾ ਕੁਛ ਪਾਣੀ ਪਾਣੀ ਤੋਂ ਬਿਨਾਂ ਕੁਛ ਨਹੀਂ ਹੈਗਾ ਗਾ

ਫਿਰ ਹੋਰ ਬਸ ਠੀਕ ਠਾਕ ਹੈ ਹੋਰ ਮਾਰ ਜਾਓ ਗੇੜਾ ਬਣਾ ਲਓ ਮੋਟਰ ਮਾਟਰ 'ਤੇ ਬਹਿ ਜਾਵਾਂਗੇ ਹਾਂ ਹਾਂ ਹਾਂ ਮੈਂ ਤਾਂ ਮੈਂ ਤਾਂ ਕਹਿੰਦਾ ਦ ਮੈਂ ਤਾਂ ਕਹਿੰਦਾ ਸੀ ਲਾ ਲੂ ਲੈਂਦੇ ਨਰਮਾ ਥੋੜ੍ਹਾ ਬਹੁਤ ਤੁਸੀਂ ਕਿੱਲਾ ਅੱਧਾ ਕਿੱਲਾ ਲਾ ਦਿੰਦੇ ਦੇਖਦੇ ਤਾਂ ਸਹੀ ਤੁਸੀਂ ਤਜ਼ਰਬਾ ਦੇਖਦੇ ਤੁਸੀਂ ਝੋਨਾ ਭੁੱਲ ਜਾਣਾ ਸੀ ਠੀਕ ਹੈ ਠੀਕ ਹੈ ਠੀਕ ਹੈ ਓਕੇ ਓਕੇ ਠੀਕ